ਵੀਹ ਦੋ ਸੌ ਪਚਵੰਜਾ ਇੱਕ ਹਜ਼ਾਰ ਪੈਂਹਠ ਤਿੰਨ ਹਜ਼ਾਰ ਚਾਰ ਸੌ ਸੱਤਰ ਦਸ ਹਜ਼ਾਰ ਅੱਠ ਸੌ ਨੱਬੇ ਇੱਕ ਲੱਖ ਇੱਕ ਸੌ ਇੱਕੀ